ਰੂਪਨਗਰ ਜ਼ਿਲ੍ਹੇ ਦੀ ਆਮ ਸਮੱਸਿਆ ਇਹ ਹੈ ਕਿ ਇੱਥੇ ਸੜਕਾਂ ਬਹੁਤ ਜ਼ਿਆਦਾ ਟੁੱਟੀਆਂ ਹੋਈਆਂ ਹਨ ਟੁੱਟੀਆਂ ਸੜਕਾਂ ਹੋਣ ਕਾਰਨ ਬਜ਼ੁਰਗਾਂ ਨੂੰ ਬਹੁਤ ਜ਼ਿਆਦਾ ਜਾਨ ਮਾਲ ਦਾ ਨੁਕਸਾਨ ਸਹਿਣਾ ਪੈਂਦਾ ਹੈ ਅਤੇ ਜਦੋਂ ਕੋਈ ਗੱਡੀ ਵਗੈਰਾ ਇਨ੍ਹਾਂ ਖੱਡਿਆਂ ਤੋਂ ਗੁਜ਼ਰਦੀ ਹੈ ਬਾਰਿਸ਼ ਹੋ ਰਹੀ ਹੁੰਦੀ ਹੈ ਤਾਂ ਸਕੂਲ ਵਾਲੇ ਬੱਚੇ ਜਿਹੜੇ ਨਾਲ ਜਾ ਰਹੇ ਹੁੰਦੇ ਹਨ ਉਨ੍ਹਾਂ ਦੀ ਯੂਨੀਫੋਮ ਖਰਾਬ ਹੋ ਜਾਂਦੀ ਹੈ ਜੇ ਉਹ ਗਿੱਲੇ ਕੱਪੜੇ ਪਾ ਕੇ ਸਕੂਲ ਜਾਂਦੇ ਹਨ ਤਾਂ ਬਿਮਾਰ ਹੋੇ ਜਾਂਦੇ ਹਨ ਜੇ ਸੁੱਕੇ ਕੱਪੜੇ ਪਾਉਣ ਲਈ ਘਰ ਜਾਂਦੇ ਹਨ ਤਾਂ ਉਹ ਲੇਟ ਹੋ ਜਾਂਦੇ ਹਨ ਦੂਜਾ ਉਨ੍ਹਾਂ ਨੂੰ ਆਪਣੇ ਅਧਿਆਪਕਾਂ ਤੋਂ ਗੱਲਾਂ ਵੀ ਸੁਣਨੀਆਂ ਪੈਂਦੀਆਂ ਹਨ ਕਿ ਹਾਂ ਤੁਸੀਂ ਲੇਟ ਹੋ ਗਏ ਹੋ ਦੂਜੀ ਇੱਥੇ ਇੱਥੇ ਦੀ ਸਮੱਸਿਆ ਇਹ ਹੈ ਕਿ ਇੱਥੇ ਬਹੁਤ ਜ਼ਿਆਦਾ ਗੰਦਗੀ ਦੇ ਢੇਰ ਥਾਂ ਥਾਂ ਲੱਗੇ ਹੋਏ ਹੁੰਦੇ ਹਨ ਜ਼ਿਆਦਾਤਰ ਸਰਕਾਰੀ ਕਰਮਚਾਰੀ ਹੜਤਾਲਾਂ 'ਤੇ ਹੀ ਰਹਿੰਦੇ ਹਨ ਉਨ੍ਹਾਂ ਨੂੰ ਜਨਤਾ ਦੀਆਂ ਸਮੱਸਿਆਵਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇੱਥੇ ਇਹ ਦੋ ਸਮੱਸਿਆਵਾਂ ਮੁੱਖ ਬਣੀਆਂ ਹੋਈਆਂ ਹਨ ਇਹਨੇ ਇਹ ਮੰਗ ਕੀਤੀ ਜਾਂਦੀ ਹੈ ਕਿ ਇਹਨਾਂ ਸਮੱਸਿਆਵਾਂ ਨੂੰ ਮੁੱਢਲੇ ਤੌਰ 'ਤੇ ਹੱਲ ਕੀਤਾ ਜਾਏ